ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਖਾਣਾ ਬਣਾਉਣ ਬਹੁਤ ਹੀ ਸ਼ੌਕ ਹੈ ਅਤੇ ਮੈਂ ਬਹੁਤ ਹੀ ਸਵਾਦਿਸ਼ਟ ਖਾਣਾ ਬਣਾਉਂਦੀ ਹਾਂ ਜੋ ਕਿ ਮੇਰੇ ਘਰਦਿਆਂ ਅਤੇ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਵੀ ਬਹੁਤ ਪਸੰਦ ਹੈ ਮੈਂ ਸਭ ਤੋਂ ਪਹਿਲਾਂ ਖਾਣਾ ਬਹੁਤ ਹੀ ਛੋਟੀ ਉਮਰ ਤੋਂ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਮੈਂ ਆਪਣੇ ਖਾਣੇ ਵਿੱਚ ਸਭ ਤੋਂ ਪਹਿਲਾਂ ਰਾਜਮਾਹ ਦੀ ਸਬਜ਼ੀ ਬਣਵਾ ਬਣਾਈ ਸੀ ਜੋ ਕਿ ਮੇਰੇ ਘਰਦਿਆਂ ਨੂੰ ਬਹੁਤ ਹੀ ਪਸੰਦ ਆਈ ਸੀ ਸਭ ਤੋਂ ਪਹਿਲਾਂ ਮੈਂ ਇਹ ਦੱਸਾਂਗੀ ਕਿ ਮੈਂ ਆਪਣੇ ਖਾਣੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੀ ਹਾਂ ਜਿਵੇਂ ਕਿ ਰਾਜਮਾਹ ਚਾਵਲ ਕੜੀ ਚਾਵਲ ਦਾਲ ਚਾਵਲ ਇਤ ਆਦਿ ਇਹ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਉਣੀਆਂ ਆਉਂਦੀਆਂ ਹਨ ਅਤੇ ਸਬਜ਼ੀਆਂ ਵਿੱਚ ਵੀ ਮੈਂ ਬਹੁਤ ਸਾਰੀਆਂ ਸਬਜ਼ੀਆਂ ਬਹੁਤ ਹੀ ਸਵਾਦਿਸ਼ਟ ਬਣਾਉਦੀ ਹਾਂ ਇਹ ਮੈਨੂੰ ਬਹੁਤ ਹੀ ਪਸੰਦ ਹੈ ਜੋ ਕਿ ਮੈਂ ਸਭ ਨੂੰ ਖਾਣਾ ਬਣਾ ਕੇ ਖਿਲਾਉਂਦੀ ਹਾਂ ਮੈਂ ਸਭ ਤੋਂ ਪਹਿਲਾਂ ਖਾਣਾ ਆਪਣੀ ਅੱਠਵੀਂ ਕਲਾਸ 'ਚ ਬਣਾਇਆ ਸੀ ਜੋ ਕਿ ਸਭ ਨੂੰ ਬਹੁਤ ਪਸੰਦ ਆਇਆ ਸੀ ਵੈਸੇ ਤਾਂ ਮੈਂ ਖਾਣਾ ਬਣਾਉਣਾ ਪੰਜਵੀਂ ਕਲਾਸ 'ਚ ਹੀ ਸ਼ੁਰੂ ਕਰ ਦਿੱਤਾ ਸੀ ਪਰ ਉਦੋਂ ਮੈਂ ਸਬਜ਼ੀ ਵਗੈਰਾ ਨਹੀਂ ਬਣਾਉਂਦੀ ਸੀ ਉਸ ਸਮੇਂ ਸਿਰਫ ਮੈਂ ਰੋਟੀਆਂ ਵਗੈਰਾ ਹੀ ਬਣਾਇਆ ਕਰਦੀ ਸੀ ਅੱਠਵੀਂ ਵਿੱਚ ਮੈਂ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਨੂੰ ਰਾਜਮਾਹ ਚਾਵਲ ਬਣਾ ਕੇ ਖਵਾਏ ਜੋ ਕਿ ਉਹਨਾਂ ਨੂੰ ਬਹੁਤ ਹੀ ਪਸੰਦ ਆਏ ਉਸ ਤੋਂ ਬਾਅਦ ਸਾਰਿਆਂ ਨੇ ਮੇਰੀ ਬਹੁਤ ਹੀ ਤਾਰੀਫ ਕੀਤੀ ਉਸ ਤੋਂ ਬਾਅਦ ਮੈਨੂੰ ਖਾਣਾ ਬਣਾਉਣ ਦਾ ਇੱਕ ਜੋਸ਼ ਜਿਹਾ ਚੜ੍ਹ ਗਿਆ ਅਤੇ ਮੈਂ ਆਪਣਾ ਅਤੇ ਆਪਣੇ ਪੂਰੇ ਪਰਿਵਾਰ ਦਾ ਖਾਣਾ ਖੁਦ ਹੀ ਬਣਾਉਣਾ ਪਸੰਦ ਕਰਦੀ ਹਾਂ